ਮੇਨ ਗੁਰਦਾਸਪੁਰ ਦੇ ਵਿੱਚ ਆਵਾਜਾਈ ਦਾ ਸਾਧਨ ਹੈ ਸੜਕਾਂ ਦੇ ਚੱਲਣ ਵਾਲੀਆਂ ਗੱਡੀਆਂ ਰੇਲਵੇ ਟਰੈਕ ਅਤੇ ਬੱਸਾਂ ਦੀ ਹੈ ਓਟੋ ਅਤੇ ਟਰੇਨਾਂ ਹਨ ਜਿਹਦੇ ਕਰਕੇ ਕਿ ਸਾਨੂੰ ਆਵਾਜਾਈ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੁੰਦੀ ਹੈ ਲੇਕਿਨ ਆਮ ਆਦਮੀ ਵਾਸਤੇ ਸਭ ਤੋਂ ਸਸਤਾ ਅਤੇ ਟਿਕਾਊ ਸਾਧਨ ਹੈ ਬੱਸਾਂ ਰੇਲਵੇ ਅਤੇ ਸੜਕਾਂ 'ਤੇ ਚੱਲਣ ਵਾਲੀਆਂ ਮੋਟਰਸਾਈਕਲਾਂ ਹਵਾਈ ਅੱਡੇ ਦਾ ਇੱਥੇ ਆਵਾਜਾਈ ਦਾ ਸਾਧਨ ਕੋਈ ਵੀ ਨਹੀਂ ਹੈ ਕਿਉਂਕਿ ਇੱਕ ਇਹ ਇੱਕ ਬਹੁਤ ਹੀ ਜ਼ਿਆਦਾ ਵੱਡਾ ਜ਼ਿਲ੍ਹਾ ਨਹੀਂ ਹੈ ਜਿੱਥੇ ਕਿ ਇੱਕ ਹਵਾਈ ਅੱਡਾ ਬਣ ਸਕੇ ਇਸ ਲਈ ਸਾਨੂੰ ਆਵਾਜਾਈ ਦਾ ਸਭ ਤੋਂ ਸਸਤਾ ਅਤੇ ਟਿਕਾਊ ਸਾਧਨ ਹੀ ਸੜਕ ਦੇ ਉੱਤੇ ਚੱਲਣ ਵਾਲੇ ਮੋਟਰਸਾਈਕਲਾਂ ਰੇਲਵੇ ਅਤੇ ਆਟੋ ਰਿਕਸ਼ੇ ਅਤੇ ਬੱਸਾਂ ਲੱਗਦੀਆਂ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਅਤੇ ਬੱਸਾਂ ਅਤੇ ਰੇਲਵੇ ਰੇਲਵੇ ਹੀ ਸਾਨੂੰ ਜ਼ਿਆਦਾ ਆਮ ਆਦਮੀ ਨੂੰ ਸਸਤੇ ਪੈਂਦੇ ਹਨ ਇਸ ਕਰਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੇਲਵੇ ਟਰੈਕ ਦੇ ਉ ਰੇਲਵੇ ਅਤੇ ਬੱਸਾਂ ਦਾ ਜ਼ਿਆਦਾ ਹੀ ਚਲਾਉਣ ਦਾ ਚਲ ਆਵਾਜਾਈ ਦਾ ਸਾਧਨ ਦਾ ਇੱਕ ਜ਼ਰੀਆ ਬਣ ਜਾਂਦਾ ਹੈ ਇਸ ਲਈ ਸਾ ਅਸੀਂ ਇੱਕ ਵਧੀਆ ਤਰੀਕੇ ਦੀ ਆਵਾਜਾਈ ਦੇ ਸਾਧਨ ਵਾਸਤੇ ਇਸ ਬੱਸਾਂ ਕਾਰਾਂ ਅਤੇ ਰੇਲਵੇ ਟਰੈਕ ਨੂੰ ਹੀ ਰੱਖਦੇ ਹਾਂ